ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਅਠਾਈ ਅਕਤੂਬਰ ਚੌਦਾਂ ਸੌ ਬਵੰਜਾ ਉੱਨੀ ਜਨਵਰੀ ਪੰਦਰਾਂ ਸੌ ਬਵੰਜਾ ਅਠਾਰਾਂ ਫਰਵਰੀ ਚੌਦਾਂ ਸੌ ਬੱਤੀ ਗਿਆਰਾਂ ਮਾਰਚ ਉੱਨੀ ਸੌ ਚਾਲੀ